ਸਾਡੇ ਖੇਤਰ ਵਿੱਚ ਕਾਰੀਗਰਾਂ ਦੀ ਸਹਾਇਤਾ ਲਈ ਵੱਖ ਵੱਖ ਸਰਕਾਰੀ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਸਰਕਾਰ ਗਰਾਂਟਾਂ ਦਿੰਦੀ ਹੈ ਘੱਟ ਵਿਆਜ ਵਾਲੇ ਕਰਜੇ ਅਤੇ ਸਥਾਨਕ ਕਲਾ ਅਤੇ ਸ਼ਿਲਪਕਾਰੀਆਂ ਨੂੰ ਸਮਰਥਨ ਦੇਣ ਲਈ ਸਬਸਿਡੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਛੋਟੇ ਉਦਯੋਗ ਜਾਂ ਘਰ ਵਿੱਚ ਹੀ ਕੰਮ ਕਰਦੀਆਂ ਮਹਿਲਾਵਾਂ ਨੂੰ ਤਰ੍ਹਾਂ ਤਰ੍ਹਾਂ ਦੇ ਕੰਮ ਦਿੱਤੇ ਜਾ ਰਹੇ ਹਨ ਜੋ ਉਹਨਾਂ ਦੀ ਰੁਚੀ ਦੇ ਮੁਤਾਬਿਕ ਹੁੰਦੇ ਹਨ ਕਈ ਵਾਰ ਕੁਝ ਮਹਿਲਾਵਾਂ ਜਿਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਉਹਨਾਂ ਨੂੰ ਜਾਂ ਉਹ ਕੁਛ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਉਹਨਾਂ ਦੀ ਰੁਚੀ ਦੇ ਮੁਤਾਬਿਕ ਉਹਨਾਂ ਦੇ ਖੇਤਰ ਵਿੱਚ ਮੁਹਾਰਤ ਹਾਸਲ ਕਰਵਾਉਣ ਲਈ ਸਿਖਲਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਉ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਵਿੱਤੀ ਸਹਾਇਤਾ ਦੇ ਕੇ ਉਹਨਾਂ ਦੇ ਕ ਨਵੇਂ ਕੰਮ ਵੀ ਸ਼ੁਰੂ ਕਰਵਾਏ ਜਾਂਦੇ ਹਨ ਜਿਸ ਨਾਲ ਕਿ ਉਹ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਸਕਣ ਇਸ ਤੋਂ ਇਲਾਵਾ ਅੱਜ ਕੱਲ੍ਹ ਸਰਕਾਰੀ ਮਹਿਲਾਵਾਂ ਸਰਕਾਰ ਮਹਿਲਾਵਾਂ ਦੇ ਖਾਤਿਆਂ 'ਤੇ ਸਬਸਿਡੀਆਂ ਵੀ ਦੇ ਰਹੀ ਹੈ ਜਿਸ ਨਾਲ ਉਹਨਾਂ ਨੂੰ ਕਿਸੇ ਦੇ ਅੱਗੇ ਝੁੱਕਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਕੰਮ ਆਪ ਕਰ ਸਕਦੀਆਂ ਹਨ ਕੁਝ ਕਲਾ ਅਜਿਹੀਆਂ ਵੀ ਹਨ ਜਿਹਨਾਂ ਨੂੰ ਵਧੇਰੇ ਮਾਨਤਾ ਦੀ ਲੋੜ ਹੈ ਉਹ ਹਨ ਫੁਲਕਾਰੀ ਕਢਾਈ ਅਤੇ ਮਾਵਾਂ ਅਤੇ ਭੈਣਾਂ ਵੱਲੋਂ ਕੱਢੇ ਜਾਂਦੇ ਕਸੀਦੇ ਜੋ ਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਕਢਾਈਆਂ ਨਾਲ ਤਰ੍ਹਾਂ ਤਰ੍ਹਾਂ ਦੇ ਮੋਰ ਅਤੇ ਪਤਾ ਨਹੀਂ ਕਿਹੜੇ ਕਿਹੜੇ ਡਿਜ਼ਾਇਨ ਪਾ ਕੇ ਨਵੀਆਂ ਨਵੀਆਂ ਕਿਸਮਾਂ ਦੀਆਂ ਚੀਜ਼ਾਂ 'ਤੇ ਕੱਢਣ ਅਤੇ ਆਧੁਨਿਕਤਾ ਦੇ ਵਿੱਚ ਪ੍ਰਵੇਸ਼ ਕਰ ਸਕਣ